ਨਮਸਕਾਰ ਸਰ ਜੀ ਮੇਰਾ ਨਾਮ ਪੂਜਾ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਖਰਾਬ ਪੈਕਿੰਗ ਬਾਰੇ ਸ਼ਿਕਾਇਤ ਕਰਨਾ ਚਾਹੁੰਦੀ ਹਾਂ ਕਿ ਮੈਂ ਆਪਣੇ ਬੇਟੇ ਦਾ ਬਰਥਡੇ ਸੀ ਮੇਰੇ ਬੇਟੇ ਦਾ ਅਤੇ ਮੈਂ ਉਹਦੇ ਲਈ ਆਰਡਰ ਕੁਛ ਕੀਤਾ ਸੀ ਜਿਸ ਵਿੱਚ ਖਾਣ ਲਈ ਚੀਜ਼ਾਂ ਮੰਗਵਾਈਆਂ ਸੀ ਅਤੇ ਉਹ ਚੀਜ਼ਾਂ ਵਿੱਚ ਮੋਮੋਸ ਸੀ ਸਪਰਿੰਗ ਰੋਲ ਸੀ ਫਿਰ ਸਮੋਸੇ ਸੀ ਗੁਲਾਬ ਜਾਮੁਨ ਸੀ ਬਰਫੀ ਸੀ ਉਹ ਸਭ ਚੀਜ਼ਾਂ ਮੰਗਵਾਈਆਂ ਸੀ ਆਰਡਰ ਕਰਕੇ ਜਿਸ ਕਾਰਨ ਉਹ ਮੰਗਵਾਉਣ ਦੇ ਲਈ ਜਿਸ ਤਰ੍ਹਾਂ ਪਾਰਸਲ ਆਇਆ ਅਤੇ ਅਸੀਂ ਖੋਲ੍ਹ ਕੇ ਦੇਖਿਆ ਤਾਂ ਉਹਦੇ ਵਿੱਚ ਪੈਕਿੰਗ ਲੀਕ ਹੋ ਗਈ ਸੀ ਗੁਲਾਬ ਜਾਮੁਨ ਦੀ ਪੈਕਿੰਗ ਲੀਕ ਹੋ ਗਈ ਸੀ ਉਸਦੀ ਚਾਸਨੀ ਸਾਰੇ ਸਮਾਨ ਵਿੱਚ ਮਿਕਸ ਹੋ ਗਈ ਸੀ ਜਿਹੜਾ ਕਿ ਅਸੀਂ ਕਿਸੇ ਨੂੰ ਖਾਣ ਲਈ ਸਰਵ ਨਹੀਂ ਸੀ ਕਰ ਸਕਦੇ ਕਿ ਉਹ ਸਾਰੀ ਹੀ ਮਿਕਸ ਹੋ ਗਈ ਸੀ ਅਤੇ ਉਸ ਖਰਾਬ ਹੋਣ ਕਰਕੇ ਕਿ ਸਾਨੂੰ ਦੁਬਾਰਾ ਤੋਂ ਆਰਡਰ ਔਰ ਕਿਤੇ ਕਰਵਾਉਣਾ ਪਿਆ ਅਤੇ ਉਹ ਪੈਕਿੰਗ ਲਈ ਜੇ ਕੀ ਸਾਨੂੰ ਉਸ ਉਸਦੇ ਪੈਸੇ ਵਾਪਸ ਮਿਲ ਜਾਣ ਜਾਂ ਕਿ ਸਾਨੂੰ ਉਹ ਪੈਕਿੰਗ ਦੇ ਬਦਲੇ ਦੁਬਾਰਾ ਕੁਛ ਖਾਣ ਲਈ ਮਿਲ ਜਾਵੇ ਅਤੇ ਉਹ ਚੇਂਜ ਕਰ ਲੈਣ ਧੰਨਵਾਦ